ਸਤਿ ਸ਼੍ਰੀ ਅਕਾਲ ਮੈਮ ਤੁਸੀਂ ਸ਼ਿਵਾਨੀ ਮੈਮ ਬੋਲ ਰਹੇ ਹੋ ਹਾਂਜੀ ਮੈਂ ਡੀ ਪੀ ਐਸ ਦੀ ਕਲੱਬ ਕੋਆਰਡੀਨੇਟਰ ਬੋਲਦੀ ਪਈ ਆ ਹਾਂਜੀ ਤੁਹਾਡਾ ਬੱਚਾ ਫਿਫਥ ਸਿਕਸਥ ਦੇ ਵਿੱਚ ਪੜ੍ਹਦਾ ਪ੍ਰਥਮ ਹਨਾ ਸ਼ਾਇਦ ਪ੍ਰਥਮ ਹਾਂਜੀ ਮੈਂ ਕਲੱਬ ਕੋਆਰਡੀਨੇਟਰ ਬੋਲਦੀ ਪਈ ਆ ਸਾਡੇ ਨਾ ਮਤਲਬ ਕਿ ਸਕੂਲ ਦੇ ਵਿੱਚ ਸਰਦੀਆਂ ਤੋਂ ਨਾ ਇੱਕ ਕੈਂਪ ਲੱਗਣਾ ਬੱਚਿਆਂ ਦੀ ਐਕਟੀਵਿਟੀ ਲਈ ਮਾਨਸਿਕ ਮਤਲਬ ਕਿ ਵਿਕਾਸ ਹੋ ਸਕੇ ਹੋਰ ਵੀ ਫਿਜੀਕਲੀ ਹੈਲਥ ਲਈ ਸਹੀ ਹੋਵੇ ਹਾਂਜੀ ਤੇ ਹਾਂਜੀ ਹਾਂਜੀ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਪੰਜਵੀਂ ਛੇਵੀਂ ਵਾਲੇ ਬੱਚੇ ਵੀ ਇਸ ਕੈਂਪ ਦੇ ਵਿੱਚ ਆਣ ਤੇ ਜਿਵੇਂ ਤੁਹਾਡਾ ਮਤਲਬ ਕਿ ਇੱਕ ਪੰਜਵੀਂ ਛੇਵੀਂ ਬੱਚਿਆਂ ਦਾ ਨਾ ਇੱਕ ਅੱਡ ਗਰੁੱਪ ਬਣੇ ਆ ਤੇ ਉਹਨਾਂ ਵਿੱਚ ਜਿਵੇਂ ਹੁਣ ਪ੍ਰਥਮ ਵੀ ਆਉਂਦਾ ਅਸੀਂ ਇਹ ਚਾਹੁੰਦੇ ਆ ਵੀ ਹਰ ਇੱਕ ਬੱਚਾ ਕੁਝ ਨਵੀਂ ਮਤਲਬ ਕੀ ਚੀਜ਼ ਸਿੱਖੇ ਹਾਂਜੀ ਨਹੀਂ ਤਾਂ ਬੱਚਾ ਪੜਨ ਦੇ ਵਿੱਚ ਹੀ ਇਨਾ ਰੁਝਿਆ ਰਹਿੰਦਾ ਅਸੀਂ ਚਾਹੁੰਦੇ ਵੀ ਪੜਾਈ ਤੋਂ ਇਲਾਵਾ ਵੀ ਕੁਝ ਨਵਾਂ ਸਿੱਖੇ ਹਾਂਜੀ ਅਸੀਂ ਮੈਮ ਇਹ ਸੋਚਿਆ ਵੀ ਬੱਚਿਆਂ ਦੀ ਮਤਲਬ ਕਿ ਖੇਡਾਂ ਵਾਸਤੇ ਬੱਚਿਆਂ ਦੀ ਖੇਡਾਂ ਵਾਸਤੇ ਹੋਰ ਵੀ ਮਤਲਬ ਕਿ ਜਿੰਦੇ ਵਿੱਚ ਬੱਚਾ ਮੋਬਾਈਲ ਤੋਂ ਦੂਰ ਰਹਿ ਸਕੇ ਹਾਂਜੀ ਇਹਦੇ ਵਿੱਚ ਨੱਚਣਾ ਹੋ ਜੂਗਾ ਪੇਂਟਿੰਗ ਬੱਚੇ ਦੇ ਮਤਲਬ ਕਿ ਜੇ ਬੱਚੇ ਦਾ ਸ਼ੁਰੂ ਤੋਂ ਹੱਥ ਖੁਲਿਆ ਹੋਵੇ ਤੇ ਪੇਂਟਿੰਗ ਬੱਚਾ ਕਰ ਲਵੇ ਤਾਂ ਅੱਗੇ ਜਾ ਕੇ ਉਹਦੇ ਲਈ ਕਿੰਨਾ ਵਧੀਆ ਹੁੰਦਾ ਉਹ ਡਰਾਇੰਗ ਦੇ ਵਿੱਚ ਕਿੰਨਾ ਵਧੀਆ ਰਹਿ ਜਾਂਦਾ ਪੇਂਟਿੰਗ ਸਿਖਾਵਾਂਗੇ ਡਰਾਇੰਗ ਸਿਖਾਵਾਂਗੇ ਪੈਨਸਿਲ ਮਤਲਬ ਕਿ ਪੈਂਸਿਲ ਫੜ ਕੇ ਉਹ ਸਿੱਧੀਆਂ ਲਾਈਨਾਂ ਮਤਲਬ ਕਿ ਉਹਨੂੰ ਬੱਚੇ ਨੂੰ ਦੱਸਣਾ ਵੀ ਕਿਵੇਂ ਮਾਰੀ ਦੀਆ ਹੋਰ ਵੀ ਗੇਮਾਂ ਬਹੁਤ ਸਾਰੀਆਂ ਖੇਡਾਂ ਖਿਡਾਵਾਂਗੇ ਅਤੇ ਨਾਲੇ ਡਾਂਸ ਨੱਚਣਾ ਵੀ ਸਿਖਾਵਾਂਗੇ ਜਿਦੇ ਵਿੱਚ ਭੰਗੜਾ ਹੋਊਗਾ ਹਾਂਜੀ ਜਿਵੇਂ ਤੁਹਾਡੇ ਬੱਚੇ ਨੂੰ ਇੰਟਰਸਟ ਮੈਂ ਸੁਣਿਆ ਸੀ ਤੁਹਾਡੇ ਬੱਚੇ ਦੇ ਦਿਲਚਸਪ ਰੱਖਦਾ ਮਤਲਬ ਕੀ ਉਹਦੇ ਚ ਬੇਸਬਾਲ ਦੇ ਵਿੱਚ ਹਨਾ ਬੇਸਬੋਲ ਦੇ ਵਿੱਚ ਉਹ ਬੜਾ ਖੇਡਦਾ ਉਹ ਜਿੱਤਿਆ ਵੀ ਬੇਸਬੋਲ ਦਾ ਇੱਕ ਅੱਧਾ ਮੈਚ ਤਾਂ ਮੈਂ ਵੇਖਿਆ ਹਾਂਜੀ ਤੇ ਇਸ ਕਰਕੇ ਅਸੀਂ ਬੇਸਬਾਲ ਵਰਗੀਆਂ ਵੀ ਗੇਮਾਂ ਰੱਖੀਆਂ ਹੋਈਆਂ ਬੇਸਬਾਲ ਬੈਡਮਿੰਟਨ ਹੋਰ ਵੀ ਬਹੁਤ ਸਾਰੀਆਂ ਗੇਮ ਹ ਤੁਸੀਂ ਮਤਲਬ ਕਿ ਜਦੋਂ ਦੇਖੋਗੇ ਨਾ ਕੈਂਪ ਵਿੱਚ ਆ ਕੇ ਤੇ ਤੁਹਾਨੂੰ ਵੀ ਬਹੁਤ ਗੇਮਾਂ ਦਿਖਣ ਨੂੰ ਮਿਲਣਗੀਆਂ ਤੇ ਤੁਸੀਂ ਵੀ ਬਹੁਤ ਵਧੀਆ ਕਹੋਗੇ ਵੀ ਇਨਾ ਵਧੀਆ ਕੈਂਪ ਬਨਿਆ ਹੋਇਆ ਨਹੀਂ ਤਾਂ ਅੱਜ ਕੱਲ ਤਾਂ ਬੱਚਿਆਂ ਵੱਡੇ ਬੱਚਿਆਂ ਵਾਸਤੇ ਸਾਰੀਆਂ ਖੇਡਾਂ ਬਣੀਆਂ ਹੋਈਆਂ ਹਾਂਜੀ ਹਾਂਜੀ ਅਸੀਂ ਇਸ ਕਰਕੇ ਤਾਂ ਹੀ ਸੋਚਿਆ ਨਾ ਵੀ ਦੇਖੋ ਬੱਚਾ ਮਤਲਬ ਕਿ ਬੱਚੇ ਦਾ ਸਰੀਰ ਚੱਲਦਾ ਰਹਿੰਦਾ ਨਹੀਂ ਤਾਂ ਅੱਜ ਕੱਲ ਬੱਚੇ ਮੋਬਾਇਲ ਫੋਨ ਕਿੱਥੇ ਛੱਡਦੇ ਪਏ ਆ ਹਾਂ ਹਾਂਜੀ ਇਸ ਕਰਕੇ ਅਸੀਂ ਕੀ ਕਹਿੰਦੇ ਆ ਐਕਟੀਵਿਟੀ ਦੇ ਵਿੱਚ ਐਰੋਬਿਕਸ ਵੀ ਰੱਖਿਆ ਹੋਇਆ ਮੈਮ ਐਰੋਬਿਕਸ ਦੇ ਵਿੱਚ ਮਤਲਬ ਕਿ ਰੋਜ ਕਸਰਤ ਕਰਾਈ ਜਾਏਗੀ ਜਿਤੇ ਜਿੱਥੇ ਬੱਚੇ ਵੋਮਅਪ ਹੋ ਜਾਣਗੇ ਤਾਂ ਕਸਰਤ ਵੀ ਕਰਾਈ ਜਾਊਗੀ ਲਾਪਿੰਗ ਮਤਲਬ ਕਿ ਹਾਸੇ ਵਾਲੀਆਂ ਵੀ ਖੇਡਾਂ ਲੱਗਣ ਲੱਗਣਗੀਆਂ ਹਾਂਜੀ ਮੈਮ ਉਹ ਤਾਂ ਤੁਸੀਂ ਐਂ ਇਦਾਂ ਕਰਿਓ ਕੱਲ ਨੂੰ ਆ ਜਿਓ ਕੱਲ ਤਾਂ ਐਤਵਾਰ ਐ ਸੋਮਵਾਰ ਆ ਜਿਓ ਬਾਰਾਂ ਤੋਂ ਤਿੰਨ ਵਜੇ ਦੇ ਵਿਚਕਾਰ ਵਿਚਕਾਰ ਹਾਂਜੀ ਉਹਨਾਂ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਮਿਲ ਜੂਗੀ ਵੀ ਕੀ ਕੀ ਹੈ ਕੀ ਕੀ ਨਹੀਂ ਮਤਲਬ ਕਿ ਮੈਨੂੰ ਤੁਸੀਂ ਆ ਕੇ ਮੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਮੈਮ